ਨੌ ਲੱਖ ਬਾਰਾਂ ਹਜ਼ਾਰ ਚਾਰ ਸੌ ਬਾਹਠ ਤਿੰਨ ਲੱਖ ਚੁਤਾਲੀ ਹਜ਼ਾਰ ਚਾਰ ਸੌ ਚੁਤਾਲੀ ਅੱਠ ਲੱਖ ਬਾਈ ਹਜ਼ਾਰ ਦੋ ਸੌ ਬਾਈ ਦੋ ਲੱਖ ਬਾਰਾਂ ਹਜ਼ਾਰ ਇੱਕ ਸੌ ਬਾਰਾਂ ਚਾਰ ਲੱਖ ਬਾਰਾਂ ਹਜ਼ਾਰ ਇੱਕ ਸੌ ਬਾਰਾਂ